ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਦੱਸੋ ਮੈਂ ਬੀ ਐੱਸ ਕੋਲਜ ਦੀ ਹੈੱਡ ਬੋਲ ਰਿਹਾ ਤੁਸੀਂ ਓਕੇ ਤੁਸੀਂ ਕੌਣ ਬੋਲ ਰਹੇ ਓ ਇੰਨਚਾਰਜ ਕਿਹੜੀ ਕਲਾਸ ਦੇ ਓਕੇ ਟਾਈਮਿੰਗ 'ਚ ਕੀ ਪ੍ਰੋਬਲਮ ਆ ਰਹੀ ਆ ਜੀ ਲੈਕਚਰ ਸ਼ੋਟ ਜਾਂ ਕੀ ਪ੍ਰੋਬਲਮ ਆ ਰਹੀ ਆ ਓਕੇ

ਓਕੇ ਠੀਕ ਹੈ ਜਿਹੜਾ ਕੋਈ ਐਂਟਰ ਕਰਕੇ ਇੱਕ ਅੱਧਾ ਲੈਕਚਰ ਕਰਕੇ ਹਨਾ ਸੋ ਸੈਟ ਕਰ ਦਾਂਗੇ ਟਾਈਮ ਉਹਦੇ ਨਾਲ ਕੀ ਪ੍ਰੋਬਲਮ ਨਹੀਂ ਆਏਗੀ ਸਿਲੇਬਸ ਨੀ ਕੰਪਲੀਟ ਹੋ ਰਿਹਾ ਉਹਨਾਂ ਦਾ ਠੀਕ ਹੈ ਕੋਈ ਨਾ ਤੁਸੀ ਤੁਸੀਂ ਦੱਸ ਦਿਓ ਕਿੰਨਾ ਕਿ ਸਿਲੇਬਸ ਰਹਿੰਦਾ ਉਸ ਦੇ ਹਿਸਾਬ ਨਾਲ ਲੈਕਚਰ ਸੈੱਟ ਕਰਦਾਗੇ ਟਾਈਮਿੰਗ ਫਿਰ ਕੋਈ ਪ੍ਰੋਬਲਮ ਨੀ ਆਏਗੀ ਇਸ ਤੋਂ ਇਲਾਵਾ ਹੋਰ ਕੋਈ ਪ੍ਰੋਬਲਮ ਓਕੇ ਜਰੂਰ ਜਲਦੀ ਤੋਂ ਜਲਦੀ ਤੁਸੀਂ ਲੈਕਚਰ ਕਦੋਂ ਕਦੋਂ ਟਾਈਮਿੰਗ ਲੈਣਾ ਚਾਹੁੰਦੇ ਹੋ ਇੰਗਲਿਸ਼ ਦੇ ਦੋ ਲੈਕਚਰ ਠੀਕ ਐ ਕਿੰਨੇ ਹਾਫ ਐਨ ਆਰ ਦੇ ਬਹੁਤ ਬਾਕੀ ਮੈਂ ਬਾਕੀ ਟੀਚਰ ਨਾਲ ਡਿਸਕਸ ਕਰਕੇ ਤੁਹਾਡੇ ਨਾਲ ਹਨਾ ਤੁਹਾਨੂੰ ਕਿੰਨੇ ਤੋਂ ਕਿੰਨੇ ਦਾ ਲੈਕਚਰ ਨਿਕਲਦਾ ਤਾਂ ਬਹੁਤਾ ਕਰਲਾਂਗੇ ਬੱਚਿਆਂ ਨੂੰ ਸਮਝਾਓ ਕੀ ਜਲਦੀ ਤੋਂ ਜਲਦੀ ਤੁਹਾਡਾ ਸਿਲੇਬਸ ਕੰਪਲੀਟ ਹੋ ਜਾਏਗਾ ਲੈਕ ਟਾਈਮ ਵੀ ਅਡਜੈਸਟ ਹੋ ਜਾਏਗਾ ਹਾਂਜੀ ਅਸੀਂ ਖੁਦ ਚਾਹੁੰਨੇ ਆ ਕੀ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਨਾ ਹਨਾ ਹਾਂਜੀ ਕੋਈ ਨਾ ਟਾਈਮਿੰਗ ਸੈਟ ਹੋਜੇਗੀ ਤੁਸੀਂ ਨੋਟ ਕਰਵਾ ਤਾਂ ਮੇਰੇ ਧਿਆਨ 'ਚ ਠੀਕ ਹੈ ਜੀ